ਪੰਜਾਬੀ ਬੋਲਣ ਵਾਲਿਆਂ ਨੂੰ ਅੱਜ ਬਹੁਤ ਸਾਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਉਹਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਦੀ ਜੀਵਨ ਸ਼ੈਲੀ ਨੂੰ ਖਤਰੇ ਵਿੱਚ ਪਾ ਰਹੀਆਂ ਹਨ ਡਾਇਸਪੋਰਾ ਭਾਈਚਾਰਿਆਂ ਵਿੱਚ ਖ਼ਾਸ ਤੌਰ 'ਤੇ ਕਨੇਡਾ ਯੂ ਕੇ ਅਤੇ ਅਮੈਰੀਕਾ ਵਰਗੇ ਦੇਸ਼ਾਂ ਵਿੱਚ ਅੰਗਰੇਜ਼ੀ ਦਾ ਦਬਦਬਾ ਅਕਸਰ ਨੌਜਵਾਨ ਪੀੜ੍ਹੀਆਂ ਨੂੰ ਪੰਜਾਬੀ ਨਾਲੋਂ ਇਸ ਨੂੰ ਤਰਜੀਹ ਦੇਣ ਲਈ ਅਗਵਾਈ ਕਰਦਾ ਹੈ ਨਤੀਜੇ ਵਜੋਂ ਪੰਜਾਬੀ ਭਾਸ਼ਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਸੱਭਿਆਚਾਰਕ ਸੰਬੰਧ ਘੱਟਦਾ ਹੈ ਇਹ ਤਬਦੀਲੀ ਪੰਜਾਬੀ ਵਿਰਸੇ ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਦੇ ਸੰਚਾਰ ਨੂੰ ਕਮਜ਼ੋਰ ਕਰ ਸਕਦੀ ਹੈ ਪੰਜਾਬ ਵਿੱਚ ਜਦੋਂ ਕਿ ਪੰਜਾਬੀ ਇੱਕ ਮਹੱਤਵਪੂਰਨ ਭਾਸ਼ਾ ਬਣੀ ਹੋਈ ਹੈ ਵਿੱਦਿਅਕ ਅਦਾਰਿਆਂ ਮੀਡੀਆ ਅਤੇ ਸਰਕਾਰ ਵਿੱਚ ਹਿੰਦੀ ਅਤੇ ਅੰਗਰੇਜ਼ੀ ਦੇ ਵੱਧ ਰਹੇ ਪ੍ਰਭਾਵ ਬਾਰੇ ਚਿੰਤਾ ਵਧ ਰਹੀ ਹੈ ਜੋ ਇਹਨਾਂ ਪ੍ਰਮੁੱਖ ਖੇਤਰਾਂ ਵਿੱਚ ਪੰਜਾਬੀ ਨੂੰ ਹਾਸ਼ੀਏ 'ਤੇ ਪਹੁੰਚਾ ਸਕਦੀ ਹੈ ਇਸ ਤੋਂ ਇਲਾਵਾ ਤੇਜੀ ਨਾਲ ਡਿਜੀਟਲ ਪਰਿਵਰਤਨ ਅਤੇ ਵਿਸ਼ਵੀਕਰਨ ਨੇ ਆਨਲਾਈਨ ਸਮੱਗਰੀ ਵਿੱਚ ਗਲੋਬਲ ਭਾਸ਼ਾਵਾਂ ਦੀ ਪ੍ਰਮੁੱਖ ਦਾ ਅਦਾ ਕਾਰਨ ਬਣਾਇਆ ਜਿਸ ਨਾਲ ਪੰਜਾਬੀ ਸਾਹਿਤ ਅਤੇ ਮੀਡੀਆ ਨੂੰ ਘੱਟ ਪੇਸ਼ ਕੀਤਾ ਗਿਆ ਹੈ ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਲੋੜੀਂਦੇ ਸਾਧਨਾਂ ਦੀ ਵੀ ਘਾਟ ਹੈ ਇਸ ਨਾਲ ਸਿੱਖਣ ਅਤੇ ਸੰਭਾਲਣ ਦੋਵਾਂ 'ਤੇ ਅਸਰ ਪੈਂਦਾ ਹੈ ਪੰਜਾਬੀ ਭਾਸ਼ਾ ਦੇ ਪ੍ਰੋਗਰਾਮਾਂ ਅਤੇ ਮੀਡੀਆ ਲਈ ਸੀਮਤ ਫੰਡਿੰਗ ਇਹਨਾਂ ਮੁੱਦਿਆਂ ਨੂੰ ਹੋਰ ਵੀ ਜੋੜਦੀ ਹੈ ਜਿਸ ਨਾਲ ਭਾਸ਼ਾ ਨੂੰ ਕਾਇਮ ਰੱਖਣਾ ਤਕ ਤਰੱਕੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਪੰਜਾਬੀ ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਨੂੰ ਆਧੁਨਿਕ ਵਿੱਦਿਅਕ ਪਾਠਕਾਰਾਂ ਵਿੱਚ ਭਾਸ਼ਾ ਨੂੰ ਜੋੜਨ ਡਿਜਿਟਲ ਮੌਜੂਦਗੀ ਨੂੰ ਵਧਾਉਣ ਪੰਜਾਬੀ ਮੀਡੀਆ ਅਤੇ ਸਾਹਿਤ ਦਾ ਸਮਰਥਨ ਕਰਨ ਅਤੇ ਇਹਨਾਂ ਰੁਝਾਨਾਂ ਨੂੰ ਰੋਕਣ ਲਈ ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਸਰਗਰਮ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਭਾਸ਼ਾ ਅਤੇ ਸੱਭਿਆਚਾਰਕ ਵਿਰਾਸਤ ਸੁਰੱਖਿਅਤ ਰੱਖਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ